ਸਵੱਛ ਭਾਰਤ ਅਭਿਆਨ ਭਾਰਤ ਸਰਕਾਰ ਦੁਆਰਾ ਆਰੰਭ ਕੀਤਾ ਗਿਆ ਇੱਕ

ਨੂੰ ਸ਼੍ਰੀ ਨਰਿੰਦਰ ਮੋਦੀ ਜੀ ਦੁਆਰਾ ਦੋ ਅਕਤੂਬਰ ਦੋ ਹਜ਼ਾਰ ਚੌਦ੍ਹਾਂ ਨੂੰ ਸ਼ੁਰੂ ਕੀਤਾ ਗਿਆ ਇਸ ਅਭਿਆਨ ਦਾ ਮੇਰੇ ਉੱਪਰ ਵੀ ਬਹੁਤ ਪ੍ਰਭਾਵ ਪਿਆ ਅਤੇ ਮੈਂ ਵੀ ਆਪਣਾ ਆਲਾ ਦੁਆਲਾ ਸਾਫ਼ ਸੁਥਰਾ ਰੱਖਣ ਲਈ ਪ੍ਰੇਰਿਤ ਹੋਇਆ ਜਦੋਂ ਸਾਡੇ ਪਿੰਡ ਵਿੱਚ ਇਸ ਅਭਿ ਅਭਿਆਨ ਤਹਿਤ ਸਫ਼ਾਈ ਦਾ ਕੰਮ ਚੱਲ ਰਿਹਾ ਸੀ ਤਾਂ ਮੈਂ ਵੀ ਇਸ ਵਿੱਚ ਹਿੱਸਾ ਲਿਆ ਸੀ ਸਾਡੇ ਆਲੇ ਦੁਆਲੇ ਦਾ ਖੇਤਰ ਕਾਫ਼ੀ ਸਾਫ਼ ਸੁਥਰਾ ਹੈ ਕਿਉਂਕਿ ਇਸ ਅਭਿਆਨ ਨਾਲ ਜੁੜ ਕੇ ਲੋਕਾਂ ਨੇ ਆਪ ਸਫ਼ਾਈ ਦੇ ਕੰਮ ਸਫਾਲ ਸੰਭਾਲਿਆ ਹੈ ਅਤੇ ਹੌਲੀ ਹੌਲੀ ਸਾਰਾ ਪਿੰਡ ਸਫ਼ਾਈ ਵੱਲ ਧਿਆਨ ਦੇਣ ਲੱਗਾ ਹੈ ਪਰ ਹਜੇ ਵੀ ਇਸ ਵਿੱਚ ਸੁਧਾਰ ਕਰਨ ਦੀ ਕਾਫ਼ੀ ਲੋੜ ਹੈ ਕਿਉਂਕੀ ਅਜੇ ਵੀ ਖਾਲੀ ਥਾਵਾਂ 'ਤੇ ਕੂੜੇ ਦੇ ਕਾਫ਼ੀ ਵੱਡੇ ਵੱਡੇ ਢੇਰ ਮਿਲ ਜਾਂਦੇ ਹਨ ਜਿਹੜੇ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ ਅਤੇ ਇਨ੍ਹਾਂ ਢੇਰਾਂ 'ਤੇ ਪਏ ਕਚਰੇ ਨੂੰ ਪਸ਼ੂ ਪੰਛੀ ਖਾ ਕੇ ਬਿਮਾਰ ਵੀ ਹੋ ਰਹੇ ਹਨ ਇਸ ਲਈ ਇਨ੍ਹਾਂ ਢੇਰਾਂ ਦੇ ਹੱਲ ਕਰਨ ਦੀ ਜ਼ਰੂਰਤ ਹਾਲੇ ਵੀ ਪਿੰਡਾਂ ਵਾਸਤੇ ਅਤੇ ਸ਼ਹਿਰਾਂ ਵਾਸਤੇ ਇੱਕ ਚੁਣੌਤੀ ਦੀ ਗੱਲ ਹੈ ਅਤੇ ਇਸ ਵਿੱਚ ਸੁਧਾਰ ਕਰਨ ਦੀ ਅਜੇ ਵੀ ਲੋੜ ਹੈ